ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੈਡਮ ਕਿਸ ਰੂਮ ਨੰਬਰ ਤੋਂ ਗੱਲ ਕਰ ਰਹੇ ਹੋ ਓਕੇ ਤੁਸੀਂ ਮੈਡਮ ਤੁਸੀਂ ਕਿਹੜੀ ਪ੍ਰੋਬਲਮ ਫੇਸ ਕਰ ਰਹੇ ਹੋ ਮੈਡਮ ਅਸੀਂ ਮਾਫ ਕਰਨਾ ਮੈਡਮ ਇਦਾਂ ਅਸੀਂ ਵਾਈਫਾਈ ਚੋਵੀ ਘੰਟੇ ਅਸੀਂ ਰੀਸੋਦਾ ਦਿੰਦੇ ਆਂ ਤੁਸੀਂ ਵਾਈਫਾਈ ਦਾ ਪਾਸਵਰਡ ਟਰਾਈ ਕੀਤਾ ਵਾ ਤੁਸੀਂ ਕਿਹੜਾ ਪਾਸਵਰਡ ਲਗਾ ਰਹੇ ਹੋ ਮੈਡਮ ਕਿਰਪਾ ਕਰਕੇ ਤੁਸੀਂ ਮੈਨੂੰ ਵਾਈਫਾਈ ਦਾ ਪਾਸਵਰਡ ਦੱਸੋਗੇ ਦੋ ਪੰਜ ਸਿਕਸ ਜੈੱਸ ਸੱਤ ਦੋ ਪੰਜ ਛੇ ਸੱਤ ਮੈਡਮ ਕਿਰਪਾ ਕਰਕੇ ਤੁਸੀਂ ਕੈਪਸ ਲੋਕ ਓਨ ਕਰਕੇ ਏ ਐਟ ਦੀ ਰੇਟ ਇਕ ਦੋ ਤਿੰਨ ਚਾਰ ਪੰਜ ਸੱਤ ਲਗਾ ਕੇ ਦੇਖੋ ਤੁਸੀਂ ਮੈਂ ਕੋਲ ਦੇ ਉੱਪਰ ਹੀ ਆ ਤੁਸੀਂ ਪਲੀਜ਼ ਟਰਾਈ ਕਰੋ ਤੁਹਾਡੇ ਕੋਲ ਇੱਕ ਫੋਨ ਹੋਰ ਹੈਗਾ ਨਾ ਤੁਸੀਂ ਉਸ ਤੋਂ ਟਰਾਈ ਕਰੋ ਤੁਹਾਡੇ ਕੋਲ ਹੈ ਕਿ ਨਹੀਂ ਮੈਡਮ ਅਸੀਂ ਏਅਰਟੈਲ ਦਾ ਕਰਵਾਉਦੇ ਆਂ ਸਾਡਾ ਚੋਵੀ ਘੰਟੇ ਸਰਵਿਸ ਹੈਗੀ ਆ ਵਾਈਫਾਈ ਪ੍ਰੋਵਾਈਡ ਅਸੀਂ ਕਰਦੇ ਆ ਨੈਟਵਰਕ ਦਾ ਤੁਸੀਂ ਪਹਿਲੇ ਸਾਡੇ ਕਸਟਮਰ ਹੋ ਜਿਨਾਂ ਨੇ ਕੰਪਲੇਂਟ ਕੀਤੀ ਆ ਕਿ ਵਾਈਫਾਈ ਦਿਨ ਅਦਰਵਾਈਜ਼ ਸਾਡੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੁਸੀਂ ਟਰਾਈ ਕਰੋਗੇ ਤੁਸੀਂ ਦੇਖੋਗੇ ਗੂਗਲ ਤੇ ਜਾ ਕੇ ਸਰਚ ਕਰੋ ਸਾਨੂੰ ਫਾਈਵ ਸਟਾਰ ਮਿਲੇ ਹੋਏ ਨੇ ਜਿਹੜੀ ਰੇਟਿੰਗ ਹੈਗੀ ਆ ਅਸੀਂ ਹਰ ਤਰਾਂ ਦੀ ਫੈਸਿਲਟੀ ਪ੍ਰੋਵਾਈਡ ਕਰ ਰਹੇ ਆਂ ਕਿਰਪਾ ਕਰਕੇ ਤੁਸੀਂ ਮੈਨੂੰ ਆਪਣਾ ਰੂਮ ਨੰਬਰ ਦੱਸੋ ਮੈਂ ਇਥੇ ਹੁਣੇ ਆਨਲਾਈਨ ਚੈੱਕ ਕਰਦਾ ਵਾਂ ਅੱਠ ਚਾਰ ਸੱਤ ਮੈਂ ਤੁਹਾਡਾ ਸ਼ੁਭ ਨਾਮ ਜਾਣ ਸਕਦਾ ਜੀ ਸਿਮਰਨਜੀਤ ਕੌਰ ਹਾਂਜੀ ਹਾਂਜੀ ਤੁਸੀਂ ਮੈਂ ਚੈੱਕ ਕਰ ਪਾ ਰਿਹਾ ਵਾਂ ਤੁਸੀਂ ਛੇ ਵੱਜ ਗਏ ਪੰਦਰਾਂ ਮਿੰਟ ਤੇ ਤੁਸੀਂ ਐਂਟਰ ਹੋਏ ਸੀ ਚੈਕ ਇਨ ਕੀਤਾ ਸੀ ਹਾਂਜੀ ਮੈਡਮ ਮਾਫ ਕਰਨਾ ਕੁਛ ਹਾਂਜੀ ਮਾਫ ਕਰਨਾ ਮੈਡਮ ਜੋ ਵੀ ਸੁਵਿਧਾ ਆਈ ਹੈ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਆ ਮੈਂ ਚੈੱਕ ਪਾ ਰਿਹਾ ਸੀ ਥੋੜਾ ਜਿਹਾ ਨੈਟਵਰਕ ਇਸ਼ੂ ਸੀ ਮੈਂ ਹੁਣ ਇਸਨੂੰ ਪਾਸਵਰਡ ਜਿਹੜਾ ਵੀ ਰੀਸੈਟ ਕਰ ਰਿਹਾ ਵਾਂ ਤੇ ਤਾਨੂੰ ਨਵਾਂ ਪਾਸਵਰਡ ਮੈਂ ਲਿਖਵਾ ਰਿਹਾ ਵਾਂ ਕਿਰਪਾ ਕਰਕੇ ਨੋਟ ਕਰਨਾ ਐੱਚ ਐਟ ਦੀ ਰੇਟ ਇਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਪਲੀਜ ਰਿਪੀਟ ਕਰਨਾ ਜੋ ਮੈਂ ਬੋਲਿਆ ਵਾ ਹਾਂਜੀ ਹਾਂਜੀ ਅੱਠ ਹਾਂਜੀ ਤੁਸੀਂ ਇਹ ਲਗਾਓਗੇ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਡੀ ਕਨੈਕਟਿਵਿਟੀ ਹੋ ਜਾਏਗੀ ਤੁਸੀ ਹੁਣੇ ਟਰਾਈ ਕਰੋ ਮੈਂ ਕਾਲ ਦੇ ਉੱਪਰ ਹੀ ਆ ਜੇਕਰ ਤੁਹਾਨੂੰ ਫਿਰ ਵੀ ਕੋਈ ਸੁਵਿਧਾ ਆਉਂਦੀ ਹੈ ਮੈਂ ਹੁਣੇ ਕੋਈ ਇਥੋਂ ਆਪਣਾ ਕਰਮਚਾਰੀ ਭੇਜਦਾ ਹਾਂ ਤੁਹਾਡਾ ਕਨੈਕਸ਼ਨ ਚੈੱਕ ਕਰੇਗਾ ਮੈਡਮ ਇਦਾਂ ਨਹੀਂ ਹੋ ਸਕਦਾ ਤੁਸੀਂ ਪਾਸਵਰਡ ਲਗਾਓ ਮੈਂ ਚੈੱਕ ਕਰ ਰਿਹਾ ਵਾਂ ਇਥੇ ਬਿਲਕੁਲ ਹਾਂਜੀ ਅੱਠ ਅੱਠ ਦੇ ਬਾਅਦ ਨੌ ਵੀ ਆ ਜੀ ਮੈਡਮ ਨੌ ਬੋਲਿਆ ਵਾ ਮੈਂ ਹਾਂਜੀ ਤੁਸੀਂ ਪਾਸਵਰਡ ਗਲਤ ਲਗਾ ਰਹੇ ਹਾਂਜੀ ਹਾਂਜੀ ਮੈਡਮ ਤੇ ਸੋਰੀ ਮਾਫ ਕਰਨਾ ਜੇ ਕੋਈ ਤੁਹਾਨੂੰ ਕੋਈ ਸੁਵਿਧਾ ਹੋਈ ਹੈ ਥੋੜੀ ਜਿਹੀ ਕਨੈਕਟੀਵਿਟੀ ਦਾ ਧੰਨਵਾਦ ਮੈਡਮ ਧੰਨਵਾਦ ਬਹੁਤ ਜਿਆਦਾ ਤੁਸੀਂ ਸਾਨੂੰ ਪਹਿਲਾਂ ਇਨਫੋਰਮ ਕਰਦੇ ਅਸੀਂ ਤੁਹਾਡੀ ਪਹਿਲਾਂ ਪ੍ਰੋਬਲਮ ਸੋਲਵ ਕਰ ਦੇਣੀ ਸੀ ਮੈਡਮ ਧੰਨਵਾਦ ਧੰਨਵਾਦ ਮੈਡਮ ਧੰਨਵਾਦ ਮੈਡਮ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ